ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਅਤੇ ਸਭ ਤੋਂ ਪਹਿਲਾਂ ਉਸ ਨੂੰ ਉਸਦੀ ਜਿਹੜੀ ਭੂਆ ਹੈ ਉਹ ਗੁੜਤੀ ਦਿੰਦੀ ਹੈ ਅਤੇ ਇਸ ਤੋਂ ਬਾਅਦ ਫਿਰ ਬੱਚੇ ਦਾ ਨਾਮਕਰਨ ਇੱਕ ਵੱਡੀ ਰਸਮ ਹੈ ਜਿੱਥੇ ਕਿ ਅਸੀਂ ਗੁਰਦੁਆਰਾ ਸਾਹਿਬ ਚ ਜਾ ਕੇ ਅਸੀਂ ਉਸ ਨੂੰ ਇੱਕ ਹੁਕਮਨਾਮਾ ਲਿਆ ਜਾਂਦਾ ਹੈ ਹੁਕਮਨਾਮੇ ਦੀ ਪਹਿਲੇ ਅਕਸ਼ਰ ਤੋਂ ਹੀ ਪਾਠੀ ਸਿੰਘ ਦੁਆਰਾ ਦੱਸਿਆ ਜਾਂਦਾ ਹੈ ਅਤੇ ਘਰ ਦੇ ਜਿਹੜੇ ਹਨ ਉਹ ਉਸੇ ਸ਼ਬਦ ਤੋਂ ਕੋਈ ਵੀ ਜਿਹੜਾ ਨਾਮ ਹੈ ਉਹ ਆਪਣੀ ਪਸੰਦ ਦਾ ਰੱਖ ਲੈਂਦੇ ਹਨ ਇਸ ਤੋਂ ਇਲਾਵਾ ਜਿਹੜਾ ਛੋਟਾ ਬੱਚਾ ਹੈ ਉਸਦੇ ਹੱਥ ਨੂੰ ਕਣਕ ਨੂੰ ਭਿਓਂ ਕੇ ਉਹਨਾਂ ਦਾ ਇੱਕ ਕੰਗਣ ਬਣਾ ਕੇ ਉਹ ਬੰਨਿਆ ਜਾਂਦਾ ਹੈ ਅਤੇ ਬੱਚਾ ਅਤੇ ਬੱਚੇ ਦੀ ਮਾਂ ਦੇ ਸਰਾਣੇ ਨ ਹਿੰਗ ਨੂੰ ਰੱਖਿਆ ਜਾਂਦਾ ਹੈ ਲਸਣ ਦੀ ਗੱਠੀ ਰੱਖੀ ਜਾਂਦੀ ਹੈ ਅਤੇ ਸਰਾਣੇ ਪਾਣੀ ਦਾ ਗਲਾਸ ਭਰ ਕੇ ਰੱਖਿਆ ਜਾਂਦਾ ਹੈ ਇਸ ਤੋਂ ਇਲਾਵਾ ਹਿੰਗ ਦਾ ਛੜਕਾ ਵੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਦੇ ਦਰਵਾਜੇ ਦੇ ਅੱਗੇ ਅੰਬ ਦੇ ਪੱਤਿਆਂ ਦਾ ਇੱਕ ਹਾਰ ਬਣਾ ਕੇ ਉਹ ਦਰਵਾਜੇ 'ਤੇ ਟੰਗਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਛੋਟੇ ਬੱਚਾ ਜਦੋਂ ਥੋੜ੍ਹੇ ਜਿਹੇ ਸਵਾ ਜਦੋਂ ਇੱਕੀ ਕ ਦਿਨਾਂ ਦਾ ਹੋ ਜਾਂਦਾ ਹੈ ਤਾਂ ਉਸ ਵੇਲੇ ਬੱਚੇ ਦੇ ਜਿਹੜੇ ਰਿਸ਼ਤੇਦਾਰ ਹਨ ਉਹ ਸਾਰੇ ਇਕੱਠੇ ਹੋ ਕੇ ਬੱਚੇ ਨੂੰ ਬਾਹਰ ਵਧਾਉਣ ਦੀ ਰਸਮ ਕਰਦੇ ਹਨ ਜਿਹਦੇ ਵਿੱਚ ਕਿ ਬੱਚੇ ਦੀ ਮਾਂ ਬੱਚੇ ਨੂੰ ਪੱਲੇ ਵਿੱਚ ਪਾ ਕੇ ਆਪਣੇ ਉਸ ਕਮਰੇ ਤੋਂ ਬਾਹਰ ਆਉਂਦੀ ਹੈ ਅਤੇ ਇਸ ਖੁਸ਼ੀ ਵਿੱਚ ਜਿਹੜਾ ਕੜਾਹ ਪ੍ਰਸ਼ਾਦ ਜਾਂ ਮੂੰਗੀ ਦਾ ਹਲਵਾ ਬਣਾ ਕੇ ਉਹ ਵੰਡਿਆ ਜਾਂਦਾ ਹੈ ਇਸ ਤੋਂ ਇਲਾਵਾ ਘੇ ਦੀ ਰਸਮ ਹੈ ਜਿਹੜੀ ਕਿ ਨਾਨਕੇ ਅਗਰ ਬੱਚਾ ਹੋਇਆ ਤਾਂ ਦਾਦਕੇ ਲੈ ਕੇ ਆਉਂਦਾ ਨਾ ਅਗਰ ਦਾਦਕੇ ਤਾਂ ਨਾਨਕੇ ਲੈ ਕੇ ਆਉਂਦੇ ਹਨ ਜਿਹਦੇ ਵਿੱਚ ਕਿ ਬੱਚੇ ਛੋਟੇ ਬੱਚੇ ਦੇ ਕੱਪੜੇ ਖਿਲੋਣੇ ਪੰਜੀਰੀ ਅਤੇ ਹੋਰ ਉਹਦੀ ਮਾਂ ਬਾਪ ਦੇ ਲਈ ਕੱਪੜੇ ਤੋਹਫਿਆਂ ਵਜੋਂ ਲੈ ਕੇ ਆ ਜਾਂਦੇ ਹਨ